ਵੈਸੇ ਤਾਂ ਗੱਲ ਕੀਤੀ ਜਾਵੇ ਸਾਡੇ ਇੱਥੇ ਨੇਤਾਵਾਂ ਦੀ ਅਤੇ ਅਸੀਂ ਮੇਰਾ ਕੋਈ ਇੰਨਾਂ ਜ਼ਿਆਦਾ ਇੰਟਰਸਟ ਨਹੀਂ ਹੈਗਾ ਕਿਉਂਕਿ ਮੈਂ ਇਸ ਚੀਜ਼ਾਂ ਉੱਤੇ ਜ਼ਿਆਦਾ ਗੱਲ ਨਹੀਂ ਕਰਦਾ ਪਰ ਗੱਲ ਕੀਤੀ ਜਾਵੇ ਸਾਡੇ ਦੋ ਲੀਡਰਾਂ ਦੀ ਜੋ ਹਾਡੇ ਇੱਕ ਪਹਿਲੇ ਦੇ ਐਮ ਐਲ ਏ ਰਹੇ ਨੇ ਜਿਹਨਾਂ ਨੇ ਪਹਿਲਾਂ ਦਸ ਸਾਲ ਰਾਜ ਕੀਤਾ ਅਤੇ ਉਸ ਤੋਂ ਬਾਅਦ ਸਾਡੇ ਅਗਲੇ ਐਮ ਐਲ ਏ ਜੋ ਕਿ ਹਣ ਦੇ ਦਸ ਸਾਲਾਂ ਦੇ ਵਿੱਚ ਰਾਜ ਕਰਨ ਡੇ ਨੇ ਸਾਡੇ ਪਹਿਲੇ ਜੋ ਦਸ ਸਾਲ ਐਮ ਐਲ ਏ ਰਹੇ ਨੇ ਉਹ ਸਾਡੇ ਗੁਰਬਚਨ ਸਿੰਘ ਬੱਬੇ ਆਲੀ ਨੇ ਜਿਹਨਾਂ ਨੇ ਸਾਡੇ ਸ਼ਹਿਰ ਨੂੰ ਬਹੁਤ ਜ਼ਿਆਦਾ ਵਿਕਾਸ ਦਿੱਤਾ ਗੱਲ ਕੀਤੀ ਜਾਵੇ ਇੱਥੇ ਮੈਰੀਟੋਰੀ ਸਕੂਲ ਖੋਲ੍ਹਿਆ ਦਫਤਰ ਖੋਲ੍ਹੇ ਹੁਣ ਅੱਜ ਦੇ ਟਾਈਮ 'ਚ ਜੇ ਗੱਲ ਕੀਤੀ ਜਾਵੇ ਸਾਰੇ ਹਰ ਇੱਕ ਦਫਤਰ ਦੇ ਵਿੱਚ ਜ ਸਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਇੱਕੋ ਇੱਕ ਬਿਲਡਿੰਗ ਦੇ ਵਿੱਚ ਤੁਸੀਂ ਹਰ ਇੱਕ ਤਰੀਕੇ ਦੇ ਬੰਦੇ ਨੂੰ ਮਿਲ ਸਕਦੇ ਹੋ ਭਾਵੇਂ ਕੋਈ ਵੀ ਮਿਨਿਸਟਰ ਹੋਵੇ ਭਾਵੇਂ ਕੋਈ ਲੀਡਰ ਹੋਵੇ ਤੁਸੀਂ ਉਹਨਾਂ ਸਾਰਿਆਂ ਨੂੰ ਮਿਲ ਸਕਦੇ ਹੋ ਜੇ ਪਾੜੇ ਜੀ ਦੀ ਗੱਲ ਪਾੜਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਡੇ ਇੱਥੇ ਸਾਫ ਸਫਾਈ ਗਲੀਆਂ ਨਾਲੀਆਂ ਸਭ ਸਾਫ ਕਰਵਾ ਦਿੱਤੀਆਂ ਸਭ ਕੁਛ ਇੱਥੇ ਸ ਗੱਲ ਕੀਤੀ ਜਾਵੇ ਸਵੱਛ ਭਾਰਤ ਅਭਿਆਨ ਦੇ ਵਰਗਾ ਹੀ ਹੋਇਆ ਅੱਜ ਕੱਲ੍ਹ ਗੰਦਗੀ ਸਾਨੂੰ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਇਹਨਾਂ ਲੀਡਰਾਂ ਦੀ ਬਦੌਲਤ ਅੱਜ ਕੱਲ੍ਹ ਸ ਹਰ ਕੋਈ ਸਹੀ ਤਰੀਕੇ ਨਾਲ ਤੁਰ ਪਾ ਰਿਹਾ ਹੈ ਹਰ ਕੋਈ ਆਪਣੀ ਚੰਗੀ ਲਾਈਫ ਜੀਅ ਪਾ ਰਿਹਾ ਹੈ ਇਸ ਲਈ ਗੱਲ ਕੀਤੀ ਜਾਵੇ ਇਹਨਾਂ ਦੋਨਾਂ ਲੀਡਰਾਂ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਜੋ ਕਿ ਅੱਜ ਦੇ ਟਾਈਮ 'ਚ ਕੋਈ ਲੀਡਰ ਇੰਨਾਂ ਜ਼ਿਆਦਾ ਕਰਦਾ ਨਹੀਂ ਹੁੰਦਾ ਗੱਲ ਕੀਤੀ ਜਾਵੇ ਇਹਨਾਂ ਦੋਨਾਂ ਲੀਡਰਾਂ ਦੀ ਦੋਨਾਂ ਨੇ ਆਪਣੀ ਜਗ੍ਹਾ ਬਹੁਤ ਵਧੀਆ ਕੰਮ ਕੀਤੇ ਅਤੇ ਆਪਣਾ ਕੰਮ ਅਤੇ ਫਰਜ਼ ਦੋਨੇ ਦੋਨਾਂ ਨੇ ਨਿਭਾਇਆ ਥੈਂਕ ਯੂ